ਛੋਟੇ ਕਾਰੋਬਾਰ ਵੀ ਬਹੁਤ ਵਧੀਆ ਭੂਮਿਕਾ ਨਿਭਾਉਂਦੇ ਹਨ ਇਸ ਕਾਰੋਬਾਰ ਨੂੰ ਢੰਗ ਨਾਲ ਕੀਤਾ ਜਾਵੇ ਤਾਂ ਬਹੁਤ ਫਾਇਦਾ ਹੁੰਦਾ ਹੈ ਪਹਿਲਾ ਫਾਇਦਾ ਇਹ ਕਿ ਸਾਨੂੰ ਟੈਕਸ ਪੇ ਕਰਨ ਦੀ ਲੋੜ ਨਹੀਂ ਹੁੰਦੀ ਅਸੀਂ ਇਸਨੂੰ ਬਿਨਾਂ ਜੀ ਐੱਸ ਟੀ ਨੰਬਰ ਜਾਂ ਟੈਕਸ ਪੇ ਕੀਤੇ ਚਲਾ ਸਕਦੇ ਹਾਂ ਅਤੇ ਇਹ ਛੋਟੀ ਜਗ੍ਹਾ 'ਤੇ ਵੀ ਕੀਤਾ ਜਾ ਸਕਦਾ ਹੈ ਇਸ ਨੂੰ ਢੰਗ ਨਾਲ ਕਰਨ ਨਾਲ ਸਾਨੂੰ ਬਹੁਤ ਪ੍ਰੋਫਿਟ ਹੁੰਦਾ ਹੈ ਕਈ ਕਾਰੋਬਾਰ ਇਸ ਤਰ੍ਹਾਂ ਦੇ ਹਨ ਜੋ ਗਲੀ ਮੁਹੱਲਿਆਂ ਵਿੱਚ ਕਰਨ ਨਾਲ ਸਾਨੂੰ ਬਹੁਤ ਹੀ ਮੋਟਾ ਪੈਸਾ ਅਰਨ ਕਰ ਸਕਦੇ ਹਾਂ ਅਸੀਂ ਜਿਵੇਂ ਕਰਿਆਨੇ ਦੀ ਦੁਕਾਨ ਸਬਜ਼ੀ ਦੀ ਦੁਕਾਨ ਐਰਾ ਵਗੈਰਾ ਅਸੀਂ ਡੇਅਰੀ ਹੋ ਗਈ ਜਿਸ ਤਰ੍ਹਾਂ ਅਸੀਂ ਕਾਫੀ ਪੈਸੇ ਅਰਨ ਕਰ ਸਕਦੇ ਹਾਂ ਅਤੇ ਕਈ ਲੋਕ ਇਹਨਾਂ ਛੋਟੀਆਂ ਛੋਟੀਆਂ ਦੁਕਾਨਾਂ ਤੋਂ ਲੱਖਾਂ ਰੁਪਏ ਕਮਾ ਰਹੇ ਹਨ ਅਤੇ ਸਾਨੂੰ ਇੱਕ ਰੁਪਏ ਦਾ ਵੀ ਟੈਕਸ ਨਹੀਂ ਪੇ ਕਰਨਾ ਚਾਹੁੰਦੇ ਅਤੇ ਇਸ ਨਾਲ ਸਾਡੇ ਬਹੁਤ ਪੈਸੇ ਬਚਦੇ ਹਨ ਅਤੇ ਸਾਡੀ ਸਿਰਦਰਦੀ ਵੀ ਬਹੁਤ ਘੱਟ ਹੁੰਦੀ ਹੈ ਨਾ ਸਾਨੂੰ ਕੋਈ ਸੀ ਏ ਹਾਇਰ ਕਰਨ ਦੀ ਲੋੜ ਹੁੰਦੀ ਹੈ ਨਾ ਸਾਨੂੰ ਕੋਈ ਵੈਬਸਾਈਟਾਂ ਦੀ ਲੋੜ ਹੁੰਦੀ ਹੈ ਜਿਸ 'ਤੇ ਉਸੇ ਅਸੀਂ ਟੈਕਸ ਪੇ ਕਰਨਾ ਹੁੰਦਾ ਹੈ